ਹਾਂ ਕੁਝ ਦਿਨ ਪਹਿਲਾਂ ਅਸੀਂ ਹਿਮਾਚਲ ਦੀ ਯਾਤਰਾ ਕੀਤੀ ਸੀ ਜਿਸ ਵਿੱਚ ਅਸੀਂ ਤਕਰੀਬਨ ਦਸ ਦਿਨ ਉੱਥੇ ਰੁਕੇ ਸੀ ਉੱਥੋਂ ਦੇ ਪਹਾੜ ਉੱਥੋਂ ਦੇ ਦਰਖਤ ਪੂਰਾ ਇਨਵਾਇਰਮੈਂਟ ਬਹੁਤ ਹੀ ਸੋਹਣਾ ਹੈ ਜੋ ਕਿ ਹਰੇਕ ਨੂੰ ਪਸੰਦ ਆ ਜਾਂਦਾ ਹੈ ਇਸ ਦਸ ਦਿਨਾਂ ਵਿੱਚ ਅਸੀਂ ਕੁਝ ਦਿਨ ਤੰਬੂ ਲਗਾ ਕੇ ਰਹੇ ਸੀ ਜੋ ਕਿ ਤੰਬੂ ਲਗਾਉਣ ਦਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਜੋ ਕਿ ਤੰਬੂ ਲਗਾ ਕੇ ਰਹਿਣ ਵਿੱਚ ਬਹੁਤ ਜ਼ਿਆਦਾ ਵਧੀਆ ਮਹਿਸੂਸ ਹੁੰਦਾ ਹੈ ਕਿਉਂਕਿ ਇਹ ਇਨਵਾਇਰਮੈਂਟ ਨਾਲ ਜੁੜ ਕੇ ਇਸ ਵਿੱਚ ਰਹਿਣ ਦਾ ਅਲੱਗ ਹੀ ਮਜ਼ਾ ਹੈ